ਅੱਜ ਕੱਲ੍ਹ ਜਿਹੜਾ ਹੈਗਾ ਰਸੋਈ ਦਾ ਕੰਮ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੋਇਆ ਕਿਉਂਕਿ ਅੱਜ ਕੱਲ੍ਹ ਇੰਨੇ ਚੰਗੇ ਚੰਗੇ ਉਪਕਰਨ ਆ ਗਏ ਆ ਜਿਹਦੇ ਨਾਲ਼ ਸਮਾਨ ਸਮੇਂ ਦੀ ਜਿਹੜੀ ਬੱਚਤ ਹੋ ਰਹੀ ਹੈ ਜਿਸ ਤਰ੍ਹਾਂ ਕਿ ਮੇਰੇ ਕੋਲ ਸਭ ਤੋਂ ਪਹਿਲਾਂ ਲਿੰਨੇ ਹਾਂ ਬੇਸਿਕ ਜਿਹੀ ਚੀਜ਼ ਲਿੰਨੇ ਹਾਂ ਆਲੂ ਪੀਲਰ ਲਿੰਨੇ ਹਾਂ ਉਹ ਆਲੂ ਪੀਲਰ ਦੇ ਨਾਲ਼ ਕੀ ਹੈ ਕਿ ਆਸਾਨੀ ਨਾਲ਼ ਫਟਾਫਟ ਜਿਹੜੇ ਆਲੂ ਉਹ ਪੀਲ ਕਰ ਸਕਦੇ ਨੇ ਉਹਦੇ ਨਾਲ਼ ਟਾਈਮ ਦੀ ਬੜੀ ਬੱਚਤ ਹੁੰਦੀ ਹੈ ਜਿਸ ਤਰ੍ਹਾਂ ਸਬਜ਼ੀ ਬਨਾਉਣ ਲੱਗੇ ਸਾਨੂੰ ਬੜਾ ਟਾਈਮ ਲੱਗਦਾ ਸੀਗਾ ਹੁਣ ਜਿਹੜਾ ਹੈਗਾ ਚੋਪਰ ਆ ਗਏ ਨੇ ਔਰ ਹੈਂਡ ਬਲੈਂਡਰ ਆ ਗਏ ਨੇ ਹੈਂਡ ਬਲੈਂਡਰ ਨਾਲ਼ ਕੀ ਹੈ ਕਿ ਅਸੀਂ ਬੜੇ ਆਸਾਨੀ ਨਾਲ਼ ਫਟਾਫਟ ਪਿਆਜ਼ ਕੱਟਦੇ ਨੇ ਉਹ ਦੋ ਮਿੰਟਾਂ ਵਿੱਚ ਜਿਹੜੇ ਪਿਆਜ਼ ਕੱਟ ਕੇ ਆ ਜਾਂਦੇ ਆ ਔਰ ਸਬਜ਼ੀ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਉਹਦੇ ਨਾਲ਼ ਕੀ ਹੈ ਕਿ ਬਹੁਤ ਸਮਾਂ ਬੱਚਤ ਹੋਗੀ ਹੈ ਉਹਦੇ ਨਾਲ਼ ਅੱਜ ਕੱਲ੍ਹ ਜਿਸ ਤਰ੍ਹਾਂ ਗ੍ਰਹਿਣੀਆਂ ਬੜੇ ਹੀ ਬਿਜ਼ੀ ਰਹਿੰਦੀਆਂ ਉਹ ਬੜਾ ਹੀ ਆਸਾਨ ਹੋ ਗਿਆ ਕੰਮ ਪ੍ਰੈਸ਼ਰ ਕੁੱਕਰ ਪ੍ਰੈਸ਼ਰ ਕੁੱਕਰ ਮਿੱਟੀ ਦੇ ਆ ਗਏ ਆਂ ਜਿਹਦੇ ਨਾਲ਼ ਕੀ ਹੈ ਕਿ ਸਾਨੂੰ ਜਿਹੜੀ ਚੰਗੀ ਸਿਹਤ ਵੀ ਮਿਲਦੀ ਹੈ ਅਤੇ ਜਿਹੜਾ ਖਾਣਾ ਵੀ ਸਾਨੂੰ ਬਹੁਤ ਚੰਗਾ ਫਟਾਫਟ ਬਣਨ ਆਲਾ ਬਣ ਜਾਂਦਾ ਏ ਮਿੱਟੀ ਦੇ ਭਾਂਡੇ ਵੈਸੇ ਵੀ ਬਹੁਤ ਚੰਗੇ ਹੁੰਦੇ ਨੇ ਔਰ ਬਹੁਤ ਚੀਜ਼ੀਆਂ ਇਹ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਹੈਗੀਆਂ ਆਪਣੀ ਰਸੋਈ ਵਿੱਚ ਦੇਖਣ ਨੂੰ ਮਿਲ ਰਹੀਆਂ ਪਹਿਲੇ ਬਹੁਤ ਸਮੇਂ ਪਹਿਲਾਂ ਜਿਹੜਾ ਹੈਗਾ ਮਧਾਣੀਆਂ ਚੱਲਦੀਆਂ ਸੀਗੀਆਂ ਜਿਹੜੀਆਂ ਜਿਹੜੇ ਪੁਰਾਣੀਆਂ ਜਿਹੜੀਆਂ ਔਰਤਾਂ ਸੀਗੀਆਂ ਆਪਣੀਆਂ ਹੱਥ ਨਾਲ਼ ਜਿਹੜੀਆਂ ਹੈਗਾ ਮੱਖਣ ਜਿਹੜੀ ਕੱਢਦੀਆਂ ਹੁੰਦੀਆਂ ਸੀ ਜਿਹਦੇ ਨਾਲ਼ ਲੰਬਾ ਸਮਾਂ ਲੱਗਿਆ ਰਹਿੰਦਾ ਸੀ ਹੁਣ ਅੱਜ ਦੇ ਯੁੱਗ ਵਿੱਚ ਜਿਹੜਾ ਹੈਗਾ ਇਲੈਕਟ੍ਰੀਕਲ ਮਧਾਣੀਆਂ ਆ ਗਈਆਂ ਨੇ ਜਿਹੜਾ ਤੁਹਾਡਾ ਦਸ ਮਿੰਟਾਂ ਵਿੱਚ ਕੰਮ ਖਤਮ ਕਰ ਦਿੰਦੀਆਂ ਨੇ